ਹਮ ਪਾਸਪੋਰਟ ਅਫਸਰ ਰਾਜਵਿੰਦਰ ਸਿੰਘ ਮੇਰੇ ਗੱਲ ਹੋ ਰਹੀ ਹੈ ਜੀ ਹਾਂਜੀ ਮੈਂ ਜੀ ਜਿੱਥੇ ਰਹਿਣਾ ਪਿਆ ਨਾ ਇੱਥੇ ਮੈਂ ਪਾਸਪੋਰਟ ਅਪਲਾਈ ਕਰਦਾ ਸੀ ਪਰ ਹੋ ਨਹੀਂ ਰਿਹਾ ਮੈਨੂੰ ਥੋੜ੍ਹਾ ਜਿਹਾ ਐਮਰਜੈਂਸੀ ਹੋ ਗਈ ਵੀ ਆਪਣੇ ਇੱਥੇ ਕਿੱਥੇ ਕਿੱਥੇ ਇਹ ਆਪਣੇ ਪੰਜਾਬ 'ਚ ਪਾਸਪੋਰਟ ਦਫ਼ਤਰ

ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਮੈਡਮ ਮੈਂ ਸਮਝਦਾ ਪਰ ਮੈਨੂੰ ਵੈਸੇ ਐਮਰਜੰਸੀ ਹੈ ਅੱਛਾ ਜੀ ਉਹ ਕਿਵੇਂ ਹੋਵੇਗਾ ਜੀ

ਨਹੀਂ ਫੀਸ ਦਾ ਤਾਂ ਬੀ ਮੈਨੂੰ ਇਹ ਦੱਸੋ ਨਾ ਵੀ ਮੈਂ ਕਿੱਥੋਂ ਅਪਲਾਈ ਕਰਾਂ ਅੰਮ੍ਰਿਤਸਰ ਕਿੱਥੋਂ ਕਰਾਂ ਜਾਂ ਫਿਰੋਜ਼ਪੁਰ ਤੋਂ ਕਰਾਂ ਹਾਂਜੀ ਹਾਂਜੀ

ਅੱਛਾ ਜੀ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਐਮਰਜੈਂਸੀ ਕਰਕੇ ਕਹਿ ਰਿਹਾ ਸੀਗਾ ਜੀ ਹਾਂਜੀ

ਹਾਂਜੀ

ਠੀਕ ਹੈ ਹਾਂਜੀ ਹਾਂਜੀ ਪਹਿਲੀ ਵਾਰੀ ਜੀ ਹਾਂਜੀ ਇੱਥੋਂ ਡੇਟ ਨਹੀਂ ਮਿਲੀ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ

ਫਿਰੋਜ਼ਪੁਰ ਕਰੀਏ ਜੀ ਫਿਰ ਠੀਕ ਹੈ ਜੀ ਥੈਂਕ ਯੂ ਮੈਮ